ਹਾਂਜੀ ਜੇਕਰ ਭਾਰਤੀ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਟਾਈਮ ਵਿੱਚ ਮੋਸਟਲੀ ਜੋ ਭਾਰਤੀ ਮੀਡੀਆ ਹੈ ਉਹ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਇਹ ਨਹੀਂ ਕਿ ਸਾਰੇ ਦਾ ਸਾਰਾ ਹੀ ਮੀਡੀਆ ਸਰਕਾਰ ਨਾਲ ਰਲ਼ ਰਲ਼ ਕੇ ਕੰਮ ਕਰਦਾ ਹੈ ਪਰ ਜੋ ਜ਼ਿਆਦਾਤਰ ਮੀਡੀਆ ਦੇ ਚੈਨਲ ਹਨ ਉਹ ਭਾਰਤੀ ਸਰਕਾਰ ਨਾਲ ਗੱਲਬਾਤ ਕਰਕੇ ਉਸ ਹਿਸਾਬ ਨਾਲ ਹੀ ਖਬਰ ਨੂੰ ਪੇਸ਼ ਕਰਦੇ ਹਨ ਪਰ ਕੁ ਬਹੁਤ ਸਾਰੇ ਮੀਡੀਆ ਦੇ ਏ ਇਹੋ ਜਿਹੇ ਵੀ ਮੀਡੀਆ ਦੇ ਚੈਨਲ ਹਨ ਜੋ ਸਪਸ਼ਟੀ ਸਪਸ਼ਟ ਤੌਰ 'ਤੇ ਖਬਰ ਨੂੰ ਪੇਸ਼ ਕਰਦੇ ਹਨ ਪਰ ਜੇਕਰ ਦੇਖਿਆ ਜਾਵੇ ਅੱਸੀ ਪ੍ਰਤੀਸ਼ਤ ਤੋਂ ਨੱਬੇ ਪ੍ਰਤੀਸ਼ਤ ਦੇ ਵਿੱਚ ਵਿੱਚ ਜੋ ਭਾਰਤੀ ਮੀਡੀਆ ਉਹ ਸਰਕਾਰ ਨਾਲ ਰਲ਼ ਕੇ ਚੱਲ ਰਿਹਾ ਹੈ ਇਸ ਦੇ ਉਲਟ ਜੋ ਦਸ ਤੋਂ ਵੀਹ ਪਰਸੈਂਟ ਭਾਰਤੀ ਮੀਡੀਆ ਹੈ ਉਹ ਨਿਰਪੱਖ ਖਬਰ ਦੇ ਰਿਹਾ ਹੈ ਜਾਂ ਅਤੇ ਅੱਜ ਦੇ ਟਾਈਮ ਵਿੱਚ ਜ਼ਿਆਦਾਤਰ ਲੋਕ ਜੋ ਭਾਰਤ ਵਿੱਚ ਸਭ ਤੋਂ ਜ਼ਿਆਦਾ ਖਬਰ ਨੂੰ ਸੁਣਦੇ ਹਨ ਉਹ ਸੁਣਦੇ ਵੀ ਨਿਰਪੱਖ ਚੈਨਲਾਂ ਨੂੰ ਹਨ ਅਤੇ ਜੇਕਰ ਮਸ਼ਹੂਰ ਅਖਬਾਰਾਂ ਅਤੇ ਨਿਊਜ਼ ਚੈਨਲਾਂ ਦੀ ਗੱਲ ਕੀਤੀ ਜਾਵੇ ਤਾਂ ਜਿੰਨੇ ਭਾਰਤ ਵਿੱਚ ਮਸ਼ਹੂਰ ਚੈਨਲ ਅਤੇ ਮਸ਼ਹੂਰ ਨਿਊਜ ਚੈਨਲ ਅਤੇ ਅਖਬਾਰ ਹਨ ਉੱਨੇ ਹੋਰ ਦੁਨੀਆ ਦੇ ਕਿਸੇ ਵੀ ਮੁਲਕ ਵਿੱਚ ਨਹੀਂ ਹਨ ਪਰ ਭਾਰਤੀ ਚੈਨਲ ਆਪਣਾ ਜੋ ਵੀ ਨਜ਼ਰੀਆ ਪੇਸ਼ ਕਰਦੇ ਹਨ ਉਹ ਸਹੀ ਤਰੀਕੇ ਨਾਲ ਨਹੀਂ ਰੱਖ ਰਹੇ ਜ਼ਿਆਦਾਤਰ